ਹੈਲੋ ਸਰ ਤੁਸੀਂ ਮੁਕਤਸਰ ਗੈਸ ਸਲੈਂਡਰ ਤੋਂ ਬੋਲ ਰਹੇ ਹੈਗੇ ਅਸੀਂ ਇੱਥੇ ਤੁਹਾਡੇ ਕੋਲੋਂ ਗੈਸ ਸਲੈਂਡਰ ਬੁੱਕ ਕਰਵਾਇਆ ਸੀਗਾ ਹੁਣ ਅਸੀਂ ਮੈਂ ਇੱਥੇ ਮੁਕਤਸਰ ਦੇ ਨਾਲ ਲੱਗਦੇ ਇੱਕ ਝਬੀਲ ਆਲੀ ਪਿੰਡ ਤੋਂ ਬਿਲੋਂਗ ਕਰਦੀ ਹੈਗੀ ਮੈਂ ਥੋ ਇੱਥੋਂ ਤੁਹਾਡੀ ਸਰਵਿਸ ਦੇ ਰਾਹੀਂ ਇੱਕ ਸਲੈਂਡਰ ਬੁੱਕ ਕਰਵਾਇਆ ਸੀ ਪਰ ਮੈਂ ਹੁਣ ਕਿਸੇ ਹੋਰ ਕੰਟਰੀ ਦੇ ਵਿੱਚ ਸ਼ਿਫਟ ਹੋ ਰਹੀ ਹੈਗੀ ਤਾਂ ਕਰਕੇ ਤੁਸੀਂ ਪਲੀਸ ਮੇਰੀ ਇਹ ਬੁਕਿੰਗ ਨੂੰ ਕੈਂਸਲ ਕਰ ਦਿਓ ਇਸ ਦੇ ਰਿਲੇਟਡ ਜਿਹੜੇ ਵੀ ਤੁਹਾਡੇ ਚਾਰਜਿਸ ਹੋਣਗੇ ਉਹ ਤੁਸੀਂ ਤੁਹਾਨੂੰ ਮੈਂ ਪੇਅ ਕਰ ਦੂੰਗੀ ਅਤੇ ਪਰ ਮੈਨੂੰ ਹੁਣ ਸਲੈਂਡਰ ਦੀ ਇਸ ਵਕਤ ਲੋੜ ਨਹੀਂ ਹੈਗੀ ਤਾਂ ਕਰਕੇ ਪਲੀਸ ਤੁਸੀਂ ਕਿਰਪਾ ਕਰੋ ਕਿ ਮੇਰੀ ਸਲੈਂਡਰ ਦੀ ਬੁਕਿੰਗ ਨੂੰ ਕੈਂਸਲ ਕਰ ਦਿਓ ਕਿਉਂਕਿ ਜੀ ਮੈਨੂੰ ਸਲੈਂਡਰ ਦੀ ਲੋੜ ਨਹੀਂ ਗੀ ਮੈਂ ਹੁਣ ਨਿਊ ਕੰਟਰੀ ਦੇ ਵਿੱਚ ਜੁਆਇਨ ਕਰ ਰਹੀ ਹੈਗੀ ਜਿਸ ਕਰਕੇ ਮੈਨੂੰ ਸਲੈਂਡਰ ਦੀ ਕੋਈ ਵੀ ਜ਼ਿਆਦਾ ਜ਼ਿਆਦਾ ਲੋੜ ਨਹੀਂ ਹੈਗੀ